ਪੰਜਾਬ ਦੇ ਵਿੱਚ ਬਹੁਤ ਹੀ ਮਹਾਨ ਜਿਹੜੇ ਲੇਖਕ ਔਰ ਕਵੀ ਹੋਏ ਹੈ ਸਮੇਂ ਸਮੇਂ 'ਤੇ ਕਾਫ਼ੀ ਜ਼ਿਆਦਾ ਲੇਖਕ ਆਉਂਦੇ ਰਹੇ ਹੈ ਆਪਾਂ ਸ਼ੁਰੂ ਤੋਂ ਲੈ ਕੇ ਕਾ ਗਰੈਜੂਏਸ਼ਨ ਵਿੱਚ ਵੀ ਦਸਵੀਂ 'ਚ ਵੀ ਪਲੱਸ ਵਨ ਪਲੱਸ ਟੂ 'ਚ ਵੀ ਕਾਫ਼ੀ ਰਾਈਟਰਸ ਬਾਰੇ ਪੜ੍ਹਿਆ ਇੱਕ ਰਾਈਟਰ ਸੁਰਜੀਤ ਪਾਤਰ ਜਿਨ੍ਹਾਂ ਦਾ ਹੁਣੇ ਹੁਣੇ ਕਾਫ਼ੀ ਨਾਮ ਸੁਣਨ ਨੂੰ ਮਿਲਿਆ ਕਿਉਂਕਿ ਉਨ੍ਹਾਂ ਦਾ ਦੀ ਡੈਥ ਹੋ ਗਈ ਆ ਗਿਆਰ੍ਹਾਂ ਮਈ ਦੋ ਹਜ਼ਾਰ ਚੌਵੀ ਨੂੰ ਉਨ੍ਹਾਂ ਬਾਰੇ ਕਾਫ਼ੀ ਸੁਣਨ ਨੂੰ ਆਪਾਂ ਦੇਖਿਆ ਅਤੇ ਪੀ ਐਚ ਡੀ ਉਨ੍ਹਾਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚੋਂ ਸੀਗੀ ਲੁਧਿਆਣਾ ਦੇ ਉਹ ਬੋਰਨ ਹੈ ਲੁਧਿਆਣਾ ਦੇ ਵਿੱਚ ਉਨ੍ਹਾਂ ਦੀ ਡੈਥ ਹੋਈ ਹੈ ਅਤੇ ਕਾਫ਼ੀ ਅੱਛੀਆਂ ਅੱਛੀਆਂ ਉਨ੍ਹਾਂ ਦੀਆਂ ਰਾਈਟਿੰਗਸ ਜਿਹੜੀਆਂ ਆਪਾਂ ਦੇਖੀਆਂ ਹੈ ਹਫ਼ਾ ਹਵਾ ਵਿੱਚ ਲਿਖੇ ਹਰਫ਼ ਵੀ ਬਹੁਤ ਵਧੀਆ ਉਨ੍ਹਾਂ ਦੀ ਰਾਈਟਿੰਗ ਹੈਗੀ ਆ ਲਫ਼ਜ਼ਾਂ ਦੀ ਦਰਗਾਹ ਉਸ ਤੋਂ ਇਲਾਵਾ ਕਾਫ਼ੀ ਉਨ੍ਹਾਂ ਨੂੰ ਪ੍ਰਾਈਸ ਵੀ ਜਿਹੜੇ ਹੈ ਉਹ ਮਿਲੇ ਹੋਏ ਹੈ ਕਾਫ਼ੀ ਜ਼ਿਆਦਾ ਉਨ੍ਹਾਂ ਦੀ ਜਿਹੜੀ ਹੈਗੀ ਹੈ ਉਹ ਨਾਮ ਹੈ ਉਨ੍ਹਾਂ ਦਾ ਉੱਨੀ ਸੌ ਤ੍ਰਿਆਨਵੇਂ ਵਿੱਚ ਉਨ੍ਹਾਂ ਨੂੰ ਸਹਿਤਿਆ ਅਕੈਡਮੀ ਅਵੋਰਡ ਮਿਲਿਆ ਹਨੇਰੇ ਵਿੱਚ ਸੁਲਗਦੀ ਵਰ ਵਰਨਮਾਲਾ ਕਰਕੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਦੋ ਹਜ਼ਾਰ ਬਾਰ੍ਹਾਂ ਦੇ ਵਿੱਚ ਅਤੇ ਉਸ ਤੋਂ ਅਲਾਵਾ ਉਨ੍ਹਾਂ ਨੂੰ ਪੰਜਾਬੀ ਸਾਹਿਤਯ ਅਕੈਡਮੀ ਅਵੋਰਡ ਵੀ ਮਿਲਿਆ ਹੋਇਆ ਹੈ ਗੰਗਾ ਦਾ ਨੈਸ਼ਨਲ ਅਵੋਰਡ ਵੀ ਮਿਲਿਆ ਹੋਇਆ ਹੈ ਹੋਰ ਵੀ ਕਈ ਤਰ੍ਹਾਂ ਦੇ ਅਵੋਰਡ ਵੀ ਉਨ੍ਹਾਂ ਨੂੰ ਮਿਲੇ ਹੋਏ ਹੈ